ਸਤਿ ਸ਼੍ਰੀ ਅਕਾਲ ਜੀ ਕੀ ਮੇਰੀ ਗੱਲ ਸ਼ ਸ਼ਿਵ ਮੋਟਰਸ ਨਾਲ ਹੋ ਰਹੀ ਹੈ ਮੈਂ ਨਿਕਿਤਾ ਗੱਲ ਕਰ ਰਹੀ ਹਾਂ ਮੈਂ ਤ ਸਤਾਰ੍ਹਾਂ ਸੈਕਟਰ ਤੋਂ ਤਰਤਾਲੀ ਸੈਕਟਰ ਲਈ ਇੱਕ ਕੈਬ ਬੁੱਕ ਕੀਤੀ ਸੀ ਜੋ ਕਿ ਡਰਾਈਵਰ ਟਾਈਮ 'ਤੇ ਪਹੁੰਚ ਗਿਆ ਸੀ ਪਰ ਉਸਦੀ ਗੱਡੀ ਵਿੱਚ ਬਿਲਕੁਲ ਵੀ ਸਫਾਈ ਨਹੀਂ ਸੀ ਕਿਉਂਕਿ ਹੁਣ ਕੋਵਿਡ ਦਾ ਟਾਈਮ ਚੱਲ ਰਿਹਾ ਹੈ ਨਾ ਹੀ ਉਸਨੇ ਮਾਸਕ ਪਾਇਆ ਹੋਇਆ ਸੀ ਅਤੇ ਨਾ ਹੀ ਉਸਦੀ ਗੱਡੀ ਵਿੱਚ ਸੈਨੇਟਾਈਜ਼ਰ ਸੀ ਅਤੇ ਇੱਦਾਂ ਲੱਗ ਰਿਹਾ ਸੀ ਜਿਵੇਂ ਗੱਡੀ ਪਤਾ ਨਹੀਂ ਕਿੰਨੇ ਟਾਈਮ ਤੋਂ ਧੋਈ ਨਹੀਂ ਹੁੰਦੀ ਇਸ ਕਰਕੇ ਜ ਉਹਨੇ ਮੇਰੇ ਨਾਲ ਰੂਡ ਬਿਹੇਵ ਵੀ ਕੀਤਾ ਕਿਉਂਕਿ ਮੈਂ ਉਹਨੂੰ ਮਾਸਕ ਪਾਉਣ ਲਈ ਅਤੇ ਸੈਨੇਟਾਈਜ਼ਰ ਗੱਡੀ 'ਚ ਰੱਖਣ ਲਈ ਬੋਲਿਆ ਸੀ ਅਤੇ ਉਸਨੇ ਮੈਨੂੰ ਅੱਧੇ ਰਸਤੇ ਵਿੱਚ ਹੀ ਉਤਾਰ ਦਿੱਤਾ ਅਤੇ ਮੈਂ ਤੁਹਾਡੀ ਸਰਵਿਸ ਤੋਂ ਬਿਲਕੁਲ ਵੀ ਖੁਸ਼ ਨਹੀਂ ਹਾਂ